ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਫੋਨ ਕੁਛ ਪੁੱਛਣ ਲਈ ਕੀਤਾ ਜੀ ਤੁਸੀਂ

ਅੱਛਾ ਜੀ ਹਾਂਜੀ ਮੈਂ ਹੁਸ਼ਿਆਰਪੁਰ ਤੋਂ ਪੰਜ ਛੇ ਸਾਲਾਂ ਤੋਂ ਰਹਿ ਰਹੀ ਆਂ ਤੇ ਹੁਸ਼ਿਆਰਪੁਰ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਮੈਡੀਕਲ ਜਿਹੜੀਆਂ ਫੈਸਿਲਿਟੀਜ਼ ਅਵੇਲੇਬਲ ਆ ਹਾਂਜੀ ਤੇ ਬਹੁਤ ਜਿਆਦਾ ਹੋਸਪਿਟਲ ਆ ਜਿੱਦਾਂ ਮਤਲਬ ਡੈਂਟਲ ਹੋਸਪੀਟਲ ਵੀ ਆ ਦੂਸਰੇ ਹਾਰਟ ਆਡੀਓ ਲੋਜਿਸਟ ਹੋਸਪਿਟਲ ਤੇ ਹੋਰ ਜਿੱਦਾਂ ਹੱਡੀਆਂ ਵਾਲੇ ਹੋਸਪਿਟਲ ਆ ਤੁਸੀਂ ਕਿਹਨਾਂ ਬਾਰੇ ਜਾਣਕਾਰੀ ਲੈਣਾ ਚਾਹੋਗੇ ਅੱਛਾ ਸਕਿੰਨ ਕੇਅਰ ਹੋਸਪਿਟਲ ਹਾਂਜੀ ਸਕਿੰਨ ਦੇ ਨਾਲ ਰਿਲੇਟਡ ਜਿਦਾਂ ਇੱਕ ਸਿਵਲ ਹੋਸਪਿਟਲ ਵੀ ਆ ਹੁਸ਼ਿਆਰਪੁਰ ਦੇ ਵਿੱਚ ਉਹਦੇ ਤੇ ਵੀ ਉਥੇ ਵੀ ਡਾਕਟਰ ਜਿਦਾਂ ਸਕਿੰਨ ਰਿਲੇਟਡ ਜਿਹੜੀਆਂ ਮੈਡੀਕੇਸ਼ਨ ਜਿਹੜੇ ਦਿੰਦੇ ਆ ਉਹ ਵੀ ਆ ਤੇ ਇੱਕ ਜਿੱਦਾਂ ਸਕਿਨ ਦੇ ਨਾਲ ਰਿਲੇਟਡ ਬੱਸ ਸਟੈਂਡ ਦੇ ਨਾਲ ਮਤਲਬ ਸਕਿਨ ਰਿਲੇਟਡ ਜਿਹੜਾ ਹੋਸਪੀਟਲ ਆ ਬੱਸ ਸਟੈਂਡ ਦੇ ਨਾਲ ਹੀ ਜਾਂ ਨੀਅਰ ਤੇ ਉਹ ਨਵਾਂ ਖੁੱਲਿਆ ਹੋਇਆ ਹੋਸਪਿਟਲ ਹਾਂਜੀ ਹਾਂਜੀ ਤੇ ਇਸ ਤੋਂ ਇਲਾਵਾ ਫਿਰ ਗੌਰਮੈਂਟ ਕਾਲਜ ਦੇ ਨਾਲ ਮਾਡਰਨ ਹੋਸਪਿਟਲ ਵੀ ਆ ਹਾਂਜੀ ਤੇ ਉੱਥੇ ਹੀ ਇੱਕ ਜਿੱਦਾਂ ਸਕਿਨ ਦੇ ਨਾਲ ਇੱਕ ਹੋਰ ਹੋਸਪੀਟਲ ਆ ਮਤਲਬ ਨਰਿੰਦਰ ਕੌਰ ਮੈਡਮ ਦਾ ਨਾਮ ਆ ਉਹ ਕਲੀਨਿਕ ਆ ਜਿਦਾਂ ਹਾਂਜੀ ਸਕਿਨ ਦੇ ਨਾਲ ਰਿਲੇਟਡ ਜਿਹੜੇ ਆ ਹਾਂਜੀ ਤੇ ਹੋਰ ਵੀ ਬਹੁਤ ਸਾਰੇ ਹੋਸਪਿਟਲ ਆ ਜਿੱਦਾਂ ਕਿ ਜਿਹੜਾ ਤੁਸੀਂ ਜੇ ਤੁਸੀਂ ਦਿਲ ਦੇ ਨਾਲ ਕੋਈ ਬਿਮਾਰੀਆਂ ਆ ਹਨਾ ਉਹਦੇ ਨਾਲ ਸੰਬੰਧਿਤ ਕੋਈ ਹੋਸਪਿਟਲ ਤੁਸੀਂ ਉਹ ਦੇਖਣਾ ਚਾਹੋਗੇ ਜਾਂ ਵਿਜਿਟ ਕਰਨਾ ਚਾਹੋਗੇ ਤਾਂ ਇੱਕ ਰਵਜੋਤ ਹੋਸਪਿਟਲ ਵੀ ਆ ਹਾਂਜੀ ਤੇ ਬਾਕੀ ਸਿਵਲ ਹੋਸਪਿਟਲ ਤਾਂ ਸਾਰਿਆਂ ਨੂੰ ਪਤਾ ਹੀ ਆ ਵੀ ਉੱਥੇ ਤਾਂ ਹਰ ਤਰ੍ਹਾਂ ਦੇ ਡਾਕਟਰ ਅਵੇਲੇਬਲ ਹੁੰਦੇ ਆ ਹਾਂਜੀ ਤੇ ਹੱਡੀਆਂ ਵਾਲੇ ਵੀ ਜਿੱਦਾਂ ਕਈ ਹੈਗੇ ਆ ਜਿੱਦਾਂ ਹਾਂਜੀ ਤੇ ਪਿੰਡਾਂ ਵਿੱਚ ਵੀ ਬਹੁਤ ਸਾਰੇ ਜਿੱਦਾਂ ਹੋਸਪਿਟਲ ਹੁੰਦੇ ਆ ਜਿੱਦਾਂ ਮਤਲਬ ਜਿੱਦਾ ਮਤਲਬ ਹੁਸ਼ਿਆਰਪੁਰ ਦੇ ਵਿੱਚ ਵੀ ਹੁੰਦੇ ਆ ਤੇ ਪਿੰਡਾਂ ਵਿੱਚ ਇਦਾਂ ਡਿਸਪੈਂਸਰੀਆਂ ਹੁੰਦੀਆਂ ਆ ਹਨਾ ਤੇ ਉਹ ਵੀ ਹਾਂਜੀ ਥਾਂ ਥਾਂ ਡਿਸਪੈਂਸਰੀਆਂ ਆ ਪਿੰਡਾਂ ਦੇ ਵਿੱਚ ਕੁਝ ਹੋਰ ਵੀ ਜਿੱਦਾਂ ਜਿਹੜੇ ਉਹ ਜਿਦਾਂ ਡਾਕਟਰ ਹੁੰਦੇ ਆ ਬਣੇ ਜਿਦਾਂ ਉਹ ਆਪਣਾ ਮੈਡੀਕਲ ਸਟੋਰ ਪਾ ਕੇ ਬੈਠੇ ਹੋ ਆ ਕੋਈ ਕਲੀਨਿਕ ਪਾ ਕੇ ਬੈਠੇ ਆ ਜਿੱਦਾਂ ਹਾਂਜੀ ਤੇ ਹੋਰ ਹੋਰ ਤੁਸੀਂ ਜਾਣਨਾ ਚਾਹੋਗੇ ਹਾਂਜੀ ਬੱਸ ਸਟੈਂਡ ਦੇ ਲਾਗੇ ਤੁਹਾਨੂੰ ਦੱਸਿਆ ਹੀ ਆ ਪਹਿਲਾਂ ਮੈਂ ਇੱਕ ਸਿਵਲ ਹੋਸਪਿਟਲ ਆ ਸਿਵਮ ਹੋਸਪਿਟਲ ਆ ਤੇ ਇੱਕ ਮਾਡਰਨ ਹੋਸਪਿਟਲ ਆ ਤੇ ਇੱਕ ਤੁਹਾਨੂੰ ਮੈਂ ਦੱਸਿਆ ਵੀ ਸਕਿਨ ਨਾਲ ਹੁਣੇ ਨਿਊ ਓਪਨ ਹੋਇਆ ਹੋਸਪਿਟਲ ਹਾਂਜੀ ਉਹ ਸਕਿਨ ਵਾਲਾ ਹਾਂਜੀ ਨਵਾਂ ਹੀ ਆ ਹੋਸਪਿਟਲ ਆ ਉਹਦਾ ਮੈਨੂੰ ਥੋੜਾ ਨਾਮ ਨੀ ਯਾਦ ਹੈਗਾ ਬਟ ਹੈ ਨਿਊ ਓਪਨ ਹੋਇਆ ਆ ਹੋਸਪੀਟਲ ਤੇ ਬਾਕੀ ਜੇ ਤੁਸੀਂ ਅਫੋਰਡੇਬਲ ਹੋਸਪਿਟਲ ਦੀ ਗੱਲ ਕਰੋਗੇ ਤਾਂ ਉਹ ਜਿਹੜਾ ਸਿਵਲ ਹੋਸਪੀਟਲ ਆ ਉਹ ਸਭ ਤੋਂ ਜਿਆਦਾ ਅਕੋਰਡਬਲ ਆ ਹਾਂਜੀ ਤੇ ਹਾਂਜੀ ਹਾਂਜੀ ਹਾਂਜੀ ਉਹੀ ਮੈਂ ਤੁਹਾਨੂੰ ਦੱਸ ਰਹੀ ਆਹ ਵੀ ਜਿਹੜਾ ਸਿਵਲ ਹੋਸਪੀਟਲ ਨਾ ਉੱਥੇ ਜਿਹੜੇ ਟੈਸਟ ਆ ਬਹੁਤ ਰੀਜਨੇਬਲ ਰੇਟ ਤੇ ਹੁੰਦੇ ਆ ਜਿਦਾਂ ਮਤਲਬ ਮਤਲਬ ਕੁਛ ਜਿਹੜੇ ਟੈਸਟ ਆ ਉਹ ਫਰੀ ਹੋ ਜਾਂਦੇ ਆ ਬਟ ਜਿਹੜੇ ਕੋਰਸ ਜਿਦਾਂ ਕਿ ਥਾਇਰਾਇਡ ਵਗੈਰਾ ਆ ਜਾਂ ਕਰੋਨਾ ਵਾਇਰਸ ਦਾ ਟੈਸਟ ਆ ਜਾਂ ਇੱਕ ਦੋ ਹੋਰ ਜਿਹੜੇ ਮੇਨ ਮੇਨ ਕੈਂਸਰ ਵਗੈਰਾ ਦੇ ਟੈਸਟ ਹੁੰਦੇ ਆ ਨਾ ਉਹ ਥੋੜੇ ਮਤਲਬ ਘੱਟ ਪ੍ਰਾਈਜ ਤੇ ਉਥੇ ਹੋ ਜਾਂਦੇ ਆ ਤੇ ਜੇ ਤੁਹਾਨੂੰ ਮੇਰੀ ਜਾਣਕਾਰੀ ਵਧੀਆ ਲੱਗੀ ਤਾਂ ਉਹਦੇ ਲਈ ਥੈਂਕਯੂ ਓਕੇ ਥੈਂਕਯੂ